ਇੱਕ ਸਮੂਹ ਵਿੱਚ ਜਾਂ ਇੱਕ ਸਾਥੀ ਨਾਲ ਯੋਗਾ ਦਾ ਅਭਿਆਸ ਇਕੱਲੇ ਅਭਿਆਸ ਦੇ ਮੁਕਾਬਲੇ ਇੱਕ ਵੱਖਰਾ ਅਨੁਭਵ ਪ੍ਰਦਾਨ ਕਰਦਾ ਹੈ ਇੱਕ ਸਮੂਹ ਸੈਟਿੰਗ ਵਿੱਚ ਸਮੂਹਿਕ ਊਰਜਾ ਅਤੇ ਸਾਂਝੀ ਵਚਨਬੱਧਤਾ ਇੱਕ ਪ੍ਰੇਰਨਾਦਾਇਕ ਅਤੇ ਉਤਸ਼ਾਹਜਨਕ ਮਾਹੌਲ ਬਣਾ ਸਕਦੀ ਹੈ ਫੋਕਸ ਅਤੇ ਆਨੰਦ ਨੂੰ ਵਧਾ ਸਕਦੀ ਹੈ ਦੂਸਰਿਆਂ ਦੀ ਮੌਜੂਦਗੀ ਅਕਸਰ ਭਾਈਚਾਰੇ ਅਤੇ ਦੋਸਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ ਜੋ ਉਤਸ਼ਾਹਿਤ ਅਤੇ ਸਹਾਇਕ ਦੋਵੇਂ ਹੋ ਸਕਦੀ ਹੈ ਨਿੱਜੀ ਸੇਵਾਵਾਂ ਨੂੰ ਅੱਗੇ ਵਧਾਉਣ ਅਤੇ ਰੁੱਝੇ ਰਹਿਣ ਵਿੱਚ ਮਦਦ ਕਰਦੀ ਹੈ ਪਾਰਟਨਰ ਯੋਗਾ ਖਾਸ ਤੌਰ 'ਤੇ ਸਹਿਯੋਗ ਅਤੇ ਆਪਸੀ ਸਹਿਯੋਗ ਦਾ ਇੱਕ ਤੱਤ ਪੇਸ਼ ਕਰਦਾ ਹੈ ਜੋ ਸਾਂਝੇ ਸੰਤੁਲਨ ਅਤੇ ਤਾਲਮੇਲ ਵਾਲੇ ਪੋਜਾਂ ਦੀ ਆਗਿਆ ਦਿੰਦਾ ਹੈ ਜੋ ਅਭਿਆਸ ਨੂੰ ਡੂੰਘਾ ਕਰ ਸਕਦਾ ਹੈ ਅਤੇ ਵਿਸ਼ਵਾਸ ਪੈਦਾ ਕਰ ਸਕਦਾ ਹੈ ਇਹ ਇੰਟਰਐਕਟਿਵ ਡਾਇਨਮਿੱਕ ਤੁਰੰਤ ਫੀਡਬੈਕ ਅਤੇ ਉਤਸ਼ਾਹ ਵੀ ਪ੍ਰਦਾਨ ਕਰ ਸਕਦਾ ਹੈ ਜੋ ਕਿ ਤਕਨੀਕਾਂ ਨੂੰ ਸੁਧਾਰਨ ਅਤੇ ਅਭਿਆਸ ਦੇ ਨਵੇਂ ਪਹਿਲੂਆਂ ਦੀ ਪੜਚੋਲ ਕਰਨ ਲਈ ਅਨਮੋਲ ਹੈ ਜਦੋਂ ਕਿ ਇਕੱਲਾ ਅਭਿਆਸ ਵਿਕਾਸ ਲਈ ਇੱਕ ਨਿੱਜੀ ਅਤੇ ਅੰਤਰਮੁਖੀ ਥਾਂ ਦੀ ਪੇਸ਼ਕਸ਼ ਕਰਦਾ ਹੈ ਦੂਜਿਆਂ ਨਾਲ ਅਭਿਆਸ ਕਰਨਾ ਸਮਾਜਿਕ ਅਤੇ ਭਾਵਨਾਤਮਕ ਪਹਿਲੂਆਂ ਨੂੰ ਜੋੜ ਕੇ ਇਸ ਨੂੰ ਵਧੇਰੇ ਸੰਪੂਰਨ ਅਤੇ ਜੁੜਿਆ ਹੋਇਆ ਸਫਰ ਬਣਾ ਕੇ ਅਨੁਭਵ ਨੂੰ ਅਮੀਰ ਬਣਾ ਸਕਦਾ ਹੈ